ਹਾਂਜੀ ਮੈਂ ਕਦੇ ਵੀ ਪੰਜਾਬੀ ਦੀ ਕੋਈ ਵੀ ਭਾਸ਼ਾ ਜਾਂ ਉਪ ਭਾਸ਼ਾ ਸਿੱਖੀ ਨਹੀਂ ਹੈ ਕਿਉਂਕਿ ਮੇਰੀ ਮਾਤ ਭਾਸ਼ਾ ਹੀ ਪੰਜਾਬੀ ਹੈ ਮੈਨੂੰ ਮੇਰੀ ਮਾਤ ਭਾਸ਼ਾ ਪੰਜਾਬੀ ਹੋਣ ਦੇ ਕਾਰਨ ਮੈਨੂੰ ਪੰਜਾਬੀ ਭਾਸ਼ਾ ਪਹਿਲਾਂ ਤੋਂ ਹੀ ਆਉਂਦੀ ਹੈ ਪੰਜਾਬੀ ਭਾਸ਼ਾ ਆਉਣਾ ਪੰਜਾਬੀ ਭਾਸ਼ਾ ਮੇਰੀ ਮਾਤ ਭਾਸ਼ਾ ਹੋਣ ਦੇ ਕਾਰਨ ਮੈਨੂੰ ਆਉਣਾ ਇਸ ਦਾ ਬਹੁਤ ਹੀ ਜ਼ਿਆਦਾ ਸੁਭਾਵਿਕ ਹੈ ਇਸ ਲਈ ਪੰਜਾਬੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੀਆਂ ਕਈ ਤਰ੍ਹਾਂ ਸਾਰੀਆਂ ਬੋਲੀਆਂ ਹਨ ਮਤਲਬ ਬੋਲੀਆਂ ਅਲੱਗ ਅਲੱਗ ਹਨ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਦੁਆਬੀ ਬੋਲੀ ਮਾਝੀ ਦੁਆਬੀ ਪੋਠੋਹਾਰੀ ਇਸ ਤਰ੍ਹਾਂ ਹਰ ਇੱਕ ਜਿਵੇਂ ਜਿਵੇਂ ਸਥਾਨ ਬਦਲਦਾ ਰਹਿੰਦਾ ਹੈ ਉਸ ਤਰ੍ਹਾਂ ਪੰਜਾਬੀ ਭਾਸ਼ਾ ਜੋ ਹੈ ਉਹ ਵੀ ਬਦਲਦੀ ਰਹਿੰਦੀ ਹੈ ਹਰ ਇੱਕ ਜਿਸੇ ਕਿ ਸਥਾਨ ਬਦਲਦਾ ਹੈ ਕਿਲੋਮੀਟਰਜ ਵੱਧਦੇ ਜਾਂਦੇ ਹਨ ਉਸ ਤਰ੍ਹਾਂ ਪੰਜਾਬੀ ਬੋਲਣ ਦਾ ਤਰੀਕਾ ਵੀ ਵੱਧਦਾ ਜਾਂਦਾ ਹੈ ਪੰਜਾਬੀ ਬੋਲਣਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕਿਆ ਹੈ ਵੱਖਰਾ ਵੱਖਰਾ ਢੰਗ ਹੋ ਹੀ ਜਾਂਦਾ ਹੈ ਕੋਈ ਕਿਸੇ ਨੂੰ ਅੰਕੜੇ ਬੋਲਦਾ ਹੈ ਕੋਈ ਕਿਸੇ ਨੂੰ ਇੱਦਾਂ ਬੋਲਦਾ ਹੈ ਇਸ ਵਿੱਚ ਬੋਲਣ ਦੇ ਜਿਵੇਂ ਕਿ ਕਈ ਲੋਕ ਹਨ ਉਹ ਅੰਕੜੇ ਬੋਲਦੇ ਹਨ ਕੋਈ ਲੋਕ ਅੰਕੜੇ ਨੂੰ ਇਸ ਤਰ੍ਹਾਂ ਬੋਲਦੇ ਹਨ ਐਵੇਂ ਹੁੰਦਾ ਹੈ ਕਿ ਜਿਵੇਂ ਜਿਵੇਂ ਸਥਾਨ ਬਦਲਦਾ ਰਹਿੰਦਾ ਹੈ ਅਤੇ ਜਿਹੜੀ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਬੋਲਣ ਦਾ ਢੰਗ ਤਰੀਕਾ ਜੋ ਹੈ ਉਹ ਬਦਲਦਾ ਰਹਿੰਦਾ ਹੈ ਪੰਜਾਬੀ ਭਾਸ਼ਾ ਜਿਹੜੀ ਹੈ ਇਹਦੀਆਂ ਖੇਤਰੀ ਉਪਭਾਸ਼ਾਵਾਂ ਬਹੁਤ ਸਾਰੀਆਂ ਹਨ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਪੰਜਾਬ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ ਮਾਝਾ ਦੁਆਬਾ ਮਾਲਵਾ ਮਾਝਾ ਦੁਆਬਾ ਮਾਲਵਾ ਦੀਆਂ ਅਲੱਗ ਅਲੱਗ ਉਪ ਭਾਸ਼ਾਵਾਂ ਹਨ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ ਹਰ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ ਇਸ ਲਈ ਕਿਹਾ ਜਾ ਸਕਦਾ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਉਸ ਵਿੱਚ ਬਹੁਤ ਸਾਰੀਆਂ ਬੋਲੀਆਂ ਬੋਲੀਆਂ ਜਾਂਦੀਆਂ ਹਨ